ਹੈਲੋ ਚੱਕੂਗਾ ਹੈਲੋ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਬਠਿੰਡੇ ਤੋਂ ਬੋਲਦੇ ਆ ਬਾਈ ਜੀ ਦਸ਼ਮੇਸ਼ ਬੱਸ ਡੀਪੂ ਤੋਂ ਬੋਲਦੇ ਹਾਂ ਜੀ ਬਠਿੰਡੇ ਤੋਂ ਅੰਮ੍ਰਿਤਸਰ ਜਾਣਾ ਬਾਈ ਜੀ ਮੇ ਮਿਲ ਜੂਗੀ ਬਾਈ ਜੀ ਮਿਲ ਜੂਗੀ ਬੱਸ ਚਾਲੀ ਸਵਾਰੀਆਂ ਵਾਲੀ ਬਹੁਤ ਵਧੀਆ ਬੱਸ ਮਿਲ ਜੂਗੀ ਸਾਫ਼ ਸੁਥਰੀ ਬਠਿੰਡੇ ਤੋਂ ਅੰਮ੍ਰਿਤਸਰ ਜਾਣਾ ਜੀ ਬਸ ਚਾਲੀ ਤੋਂ ਪਨਤਾਲੀ ਸਵਾਰੀਆਂ ਵਿੱਚ ਬੈਠ ਜਾਂਦੀਆਂ ਚਾਲੀ ਸਵਾਰੀਆਂ ਹਾਂ ਬੱਸ ਏ ਸੀ ਆ ਬਾਈ ਜੀ ਟੂਰਿਸਟ ਬੱਸਾਂ ਸਾਡੇ ਕੋਲ ਉਹਨਾਂ ਬੱਸਾਂ ਚੋਂ ਹੀ ਭੇਜਾਂਗੇ ਬਾਈ ਜੀ ਚਾਲੀ ਸਵਾਰੀਆਂ ਤੁਹਾਨੂੰ ਅਰਾਮਦਾਇਕ ਸਾਡਾ ਡਰਾਈਵਰ ਲੈ ਕੇ ਜਾਊਗਾ ਅੰਮ੍ਰਿਤਸਰ ਬਾਈ ਜੀ ਹਾਂ ਕਦੋਂ ਜਾਣਾ ਬਾਈ ਜੀ ਬਸ ਤੁਸੀਂ ਆਪਣੀਆਂ ਜਿੰਨੀਆਂ ਸਵਾਰੀਆਂ ਉਹਨਾਂ ਦੀ ਆਪਣੇ ਕੋਲ ਲਿਸਟ ਬਣਾ ਲਓ ਮੋਬਾਈਲ ਨੰਬਰ ਲਿਖ ਲਓ ਜੀ ਅਤੇ ਮੈਨੂੰ ਫੋਨ ਕਰਕੇ ਦੱਸ ਦਿਓ ਜੀ ਕਿ ਇੰਨੇ ਵਜੇ ਚੱਲਣਾ ਸੁਬਹ ਜਾਂ ਸ਼ਾਮ ਨੂੰ ਜੀ ਹਾਂਜੀ ਬੱਸ ਬਾਈ ਜੀ ਬਸ ਬਹੁਤ ਸਾਫ਼ ਸੁਥਰੀ ਹੈ ਬਾਈ ਜੀ ਸਾਰੀ ਬਸ ਏ ਸੀ ਹੈ ਪਰਦੇ ਲੱਗੇ ਹੋਏ ਆ ਡਰਾਈਵਰ ਕਨੈਕਟਰ ਬਹੁਤ ਵਧੀਆ ਸਾਡੇ ਠੀਕ ਹੈ ਨਾ ਬਸ ਦੀ ਸਰਵਿਸ ਤੁ ਤੁਹਾਨੂੰ ਐਤਕੀ ਦੇਵਾਂਗੇ ਤੁਸੀਂ ਅੱਗੇ ਤੋਂ ਵੀ ਸਾਨੂੰ ਵੀ ਮੌਕਾ ਦਿਆ ਕਰੋਗੇ ਬਾਈ ਜੀ ਯਾਦ ਹੀ ਰੱਖੋਗੇ ਵੀ ਬਾਕਿਆ ਗੱਡੀ ਭੇਜੀ ਸੀ ਬਾਈ ਜੀ ਸਾਡਾ ਡਰਾਈਵਰ ਬਹੁਤ ਵਧੀਆ ਉਹ ਪੂਰਾ ਜਾਣਕਾਰ ਆ ਅੰਮ੍ਰਿਤਸਰ ਜਾਂਦਾ ਆਉਂਦਾ ਰਹਿੰਦਾ ਬਾਈ ਜੀ ਹਾਂਜੀ ਤੁਸੀਂ ਸ਼ਾਮ ਨੂੰ ਲਾ ਲਓ ਬਾਈ ਜੀ ਫੋਨ ਸ਼ਾਮ ਨੂੰ ਤੁਸੀਂ ਫਾਈਨਲ ਕਰਕੇ ਦੱਸ ਦਿਓ ਬਾਈ ਜੀ ਹਾਂ ਤੁਹਾਨੂੰ ਹਾਂਜੀ ਨਹੀਂ ਜੀ ਅਸੀਂ ਤਿੰਨ ਹਜ਼ਾਰ ਸਵਾਰੀ ਦਾ ਜੀ ਜਾਣ ਆਉਣ ਅਪ ਡਾਊਨ ਦਾ ਜੀ ਹਾਂਜੀ ਤਿੰਨ ਹਜ਼ਾਰ ਰੁਪਇਆ ਤੁਹਾਡਾ ਇੱਕ ਸਵਾਰੀ ਦਾ ਹੋਊਗਾ ਜੀ ਉਹ ਬਸ ਸਾਰਿਆਂ ਦੀ ਜਿੰਮੇਵਾਰੀ ਤੁਹਾਡੀ ਹੋਊਗੀ ਜੀ ਚਾਲੀ ਸਵਾਰੀਆਂ ਤਾਂ ਹਾਂਜੀ ਅਤੇ ਸਾਨੂੰ ਟੈ ਟਾਈਮ ਦੱਸ ਦਿਓ ਡਰਾਈਵਰ ਸਾਡਾ ਉੱਥੇ ਗੱਡੀ ਲੈ ਕੇ ਆਜੂਗਾ ਜੀ ਗੱਡੀ ਏ ਸੀ ਹੈ ਸਾਫ਼ ਹੈ ਜੀ ਬਸ ਓਕੇ ਜੀ ਸਾਨੂੰ ਰਿੰਗ ਕਰ ਦਿਓ ਫੋਨ ਕਾਲ ਕਰ ਦਿਓ ਬਸ ਪਹੁੰਚ ਜਾਊਗੀ ਓਕੇ